ਵੀ ਪਹਿਲੋਂ ਤਾਂ ਵਿਆਹਾਂ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਹੁੰਦੀ ਸੀ ਪਹਿਲੇ ਸਮਿਆਂ 'ਚੋਂ ਕਿਉਂਕਿ ਉਦੋਂ ਪਾਣੀ ਦੀ ਮਾਤਰਾ ਬਹੁਤ ਘੱਟ ਹੁੰਦੀ ਸੀਗੀ ਉਦੋਂ ਆਪਣੇ ਇੰਨੇ ਵੀ ਮੋਟਰਾਂ ਨਹੀਂ ਸੀ ਹੁੰਦੀਆਂ ਹੁੰਦੀਆਂ ਅਤੇ ਉਦੋਂ ਲੋਕ ਕੈਂਟਰਾਂ 'ਚ ਪਾਣੀ ਲੈਣਾ ਅਤੇ ਟੈਂਕੀਆਂ ਭਰ ਲੈਣੀਆਂ ਫੁੱਲ ਟੈਂਕੀਆਂ ਵੱਡੀਆਂ ਵੱਡੀਆਂ ਟੈਂਕੀਆਂ ਚੱਲਦੀਆਂ ਹੁੰਦੀਆਂ ਸੀ ਉਹ ਭਰ ਲੈਣੀਆਂ ਅੱਜ ਕੱਲ੍ਹ ਦੇ ਤਾਂ ਸਭ ਦੇ ਆਪਣੇ ਘਰਾਂ 'ਚ ਤੁਹਾਨੂੰ ਪਤਾ ਹੀ ਹੈ ਵੀ ਮੱਛੀ ਬੋਰ ਹੋਏ ਹੋਏ ਨੇ ਕੋਈ ਆਮ ਹੀ ਘਰ ਹੋਵੇਗਾ ਜਿੱਧਰ ਨਹੀਂ ਹੈ ਵੈਸੇ ਤਾਂ ਸਭ ਘਰਾਂ 'ਚ ਹੁੰਦਾ ਹੈ ਕਿਉਂ ਕਿ ਪਾਣੀ ਵੇ ਵਿਆਹਾਂ ਦੇ ਵੱਡੇ ਪ੍ਰੋਗਰਾਮ ਸਮਾਗਮਾਂ ਵਿੱਚ ਤਾਂ ਆਪਾਂ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਹੁਣ ਤਾਂ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਜਾਣਦੇ ਹੋ ਵੀ ਆਪਣੇ ਮੱਛੀ ਬੋਰ ਹੋਏ ਹੋਏ ਹਨ ਅਤੇ ਆਪਾਂ ਨੂੰ ਪਾਣੀ ਦੀ ਇੰਨੀ ਸਮੱਸਿਆ ਹੁੰ ਅੱਜ ਦੇ ਸਮੇਂ 'ਚ ਤਾਂ ਨਹੀਂ ਹੁੰਦੀ ਕਿਉਂਕਿ ਆਪਾਂ ਪਾਣੀ ਦੀ ਟੈਂਕੀ ਮੱਛੀ ਬੋਰ ਕਰਵਾਏ ਹੋਏ ਨੇ ਟੈਂਕੀਆਂ ਭਰੀ ਭਰ ਲਈ ਦੀਆਂ ਪਾਣੀ ਵਰਤਣ ਨੂੰ ਬਹੁਤ ਖੁੱਲ੍ਹਾ ਮਿਲ ਜਾਂਦਾ ਹੈ ਜਿਆਦੇ ਤਾਂ ਆਪਾਂ ਨੂੰ ਉਦੋਂ ਹੀ ਸਮੱਸਿਆ ਆਉਂਦੀ ਹੈ ਜਦੋਂ ਲੈਟ ਜਾਂਦੀ ਹੈ ਅਤੇ ਉਹ ਵੀ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਜਨੈਟਰ ਲਿਆ ਹੈ ਲਿਆਉਂਦੇ ਹੁੰਦੇ ਨੇ ਅਤੇ ਜਨੈਟਰ ਆਪਾਂ ਚਲਾ ਲਈ ਦੇ ਅਤੇ ਪਾਣੀ ਆਪਣੀਆਂ ਮੋਟਰਾਂ ਚੱਲ ਜਾਂਦੀਆਂ ਹਨ ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਪਾਣੀ ਦੀ ਵੀ ਐਡੀ ਸਮੱਸਿਆ ਨਹੀਂ ਹੁੰਦੀ ਕਿਉਂਕਿ ਪਾਣੀ ਦਾ ਖ਼ਾਸ ਪ੍ਰਬੰਧ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਪਹਿਲੋਂ ਪਹਿਲਾਂ ਸਮਿਆਂ 'ਚ ਜ਼ਿਆਦਾ ਮਹਿਸੂਸ ਹੁੰਦਾ ਸੀ ਅੱਜ ਕੱਲ੍ਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਆਪਣੇ ਘਰਾਂ 'ਚ ਮੱਛੀ ਬੋਰ ਹੋਏ ਪਹਿਲੋਂ ਪਹਿਲਾਂ ਲੋਕ ਨਲਕਿਆਂ ਦਾ ਵੀ ਨਲਕਿਆਂ ਦੇ ਵੀ ਪਾਣੀ ਭਰਦਾ ਸੀ ਅੱਜ ਕੱਲ੍ਹ ਤਾਂ ਵੀ ਨਲਕੇ ਵੀ ਕਿਤੇ ਆਮ ਘਰਾਂ 'ਚ ਹੀ ਵੇਖਣ ਨੂੰ ਮਿਲਦੇ ਹਨ ਹਾਂਜੀ ਧੰਨਵਾਦ